ਸਾਡੇ ਖੇਤਰ ਵਿੱਚ ਪ੍ਰਮੁੱਖ ਬੈਂਕ ਪੰਜਾਬ ਨੈਸ਼ਨਲ ਬੈਂਕ ਸਟੇਟ ਬੈਂਕ ਆਫ ਇੰਡੀਆ ਐਚ ਡੀ ਐਫ ਸੀ ਅਤੇ ਐਕਸਿਸ ਬੈਂਕ ਆਦਿ ਅਤੇ ਹੋਰ ਵੀ ਬਹੁਤ ਬੈਂਕ ਹਨ ਮੈਂ ਆਪਣੇ ਲਈ ਅਰਜੀ ਸਟੇਟ ਬੈਂਕ ਆਫ ਇੰਡੀਆ ਵਿੱਚ ਦੇਵਾਂਗੀ ਕਿਉਂਕਿ ਇਹ ਇੱਕ ਭਰੋਸੇਮੰਦ ਅਤੇ ਸਰਕਾਰੀ ਬੈਂਕ ਹੈ ਇਹ ਦੇਸ਼ ਦਾ ਨੰਬਰ ਵੰਨ ਬੈਂਕ ਹੈ ਬੀਮੇ ਵਿੱਚ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਇਹਨਾਂ ਦਾ ਸਟਾਫ ਦਾ ਕੰਮ ਕਰਨ ਦਾ ਢੰਗ ਮੈਨੂੰ ਬਹੁਤ ਵਧੀਆ ਲੱਗਦਾ ਹੈ ਇਸ ਲਈ ਬੀਮੇ ਲਈ ਮੈਂ ਸਟੇਟ ਬੈਂਕ ਆਫ ਇੰਡੀਆ ਜਾਵਾਂਗੀ